ਆਪਣੇ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਬਾਰੇ ਬਹੁਤ ਹੀ ਅੱਛੀ ਅੱਛੀ ਗੱਲਾਂ ਹਨ ਸਾਡੇ ਸਮਾਜ ਵਿੱਚ ਖੇਡਾਂ ਦਾ ਬਹੁਤ ਹੀ ਮਹੱਤਵ ਹੈ ਜਿਸ ਕਾਰਨ ਕਈ ਲੋਕ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰਾਂ ਨੂੰ ਵੀ ਹਰਾ ਦਿੰਦੇ ਹਨ ਜਿੱਦਾਂ ਕ੍ਰਿਕੇਟ ਵਿੱਚ ਵਿਰਾਟ ਕੋਹਲੀ ਰੋਹਿਤ ਸ਼ਰਮਾ ਅਤੇ ਹੋਰ ਕਈ ਕ੍ਰਿਕੇਟਰ ਸਨ ਜਿਹੜੇ ਛੋਟੇ ਛੋਟੇ ਸੀ ਅਤੇ ਗਰੀਬ ਸੀ ਅਤੇ ਪੇਂਡੂ ਸੀ ਅਤੇ ਹੁਣ ਉਹ ਬਹੁਤ ਹੀ ਵੱਡੇ ਵੱਡੇ ਇੰਟਰਨੈਸ਼ਨਲ ਮੈਚ ਵੀ ਖੇਡਦੇ ਹਨ ਅਤੇ ਫੁੱਟਬੋਲ ਵਿੱਚ ਵੀ ਸੁਨੀ ਸੁਨੀਲ ਨਾਂ ਦਾ ਇੱਕ ਇੰਡੀਅਨ ਫੁੱਟਬੋਲਰ ਹੈ ਜਿਹੜਾ ਛੋਟਾ ਹੁੰਦਾ ਸੀ ਅਤੇ ਗਰੀਬ ਹੁੰਦਾ ਸੀ ਅਤੇ ਹੁਣ ਬਹੁਤ ਹੀ ਅਮੀਰ ਹੋ ਗਿਆ ਹੈ ਅਤੇ ਇਸ ਨਾਲ ਮਿਹਨਤ ਕਰ ਕਰਕੇ ਲੋਕ ਅਮੀਰ ਬਣਦੇ ਹਨ ਅਤੇ ਖੇਡਾਂ ਖੇਡ ਖੇਡ ਕੇ ਅਤੇ ਇਸ ਬਾਰੇ ਪੇਂਡੂਆਂ ਲੋਕਾਂ ਦੀ ਵੀ ਬਹੁਤ ਅੱਛੀ ਰਾਏ ਹੈ ਕਿਉਂ ਪਹਿਲੇ ਤਾਂ ਕਈ ਪੇਂਡੂ ਲੋਕ ਇਹ ਸੋਚਦੇ ਸੀ ਕਿ ਪੜ੍ਹ ਲਿਖ ਕੇ ਹੀ ਅੱਛੇ ਬਣਦੇ ਹਨ ਅਤੇ ਅਮੀਰ ਬਣਦੇ ਹਨ ਪਰ ਹੁਣ ਇਹ ਸਾਰੀ ਚੀਜ਼ਾਂ ਗਲਤ ਹੋ ਗਈਆਂ ਹਨ ਹੁਣ ਜਿਹੜੇ ਲੋਕ ਖੇ ਜਿਹੜੀ ਚੀਜ਼ 'ਚ ਅੱਛੇ ਹੁੰਦੇ ਹਨ ਉਸ ਵਿੱਚ ਹੀ ਅੱਵਲ ਆਉਂਦੇ ਹਨ ਜਿੱਦਾਂ ਕਈ ਲੋਕ ਖੇਡਾਂ ਵਿੱਚ ਅੱਵਲ ਹੁੰਦੇ ਹਨ ਅਤੇ ਉਸ ਵਿੱਚ ਹੀ ਆਉਂਦੇ ਹਨ ਤਾਂ ਕਈ ਲੋਕ ਪੜ੍ਹਾਈ ਵਿੱਚ ਅੱਵਲ ਹੁੰਦੇ ਹਨ ਅਤੇ ਉਸ ਵਿੱਚ ਹੀ ਆਉਂਦੇ ਹਨ ਖੇਡਾਂ ਸਾਡੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਨ ਅਤੇ ਫਿਟ ਰਹਿੰਦੇ ਹਨ ਅਤੇ ਸਾਡੇ ਹੋਰ ਵੀ ਕਈ